ਪੰਜਾਬ ਦੀ ਸਿਆ ਸਿਆਸੀ ਪ੍ਰਕਿਰਿਆ ਵਿੱਚ ਸਿਵਿਲ ਸੁਸਾਇਟੀ 'ਤੇ ਗੈਰ ਸਰਕਾਰੀ ਸੰਸ ਸੰਸਥਾਵਾਂ ਦੀ ਭੂਮਿਕਾ ਦਾ ਵਰਨਣ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਕਿ ਪੰਜਾਬ ਸਰਕਾਰ ਨੇ ਜਿੱਦਾਂ ਕਿ ਵਿਡੋਡ ਜਨਾਨੀਆਂ ਜਿਹਨਾਂ ਦੇ ਤਲਾਕ ਹੋਏ ਹੋਏ ਆ ਉਹਨਾਂ ਲਈ ਵੀ ਬਹੁਤ ਕੁਛ ਸੰਸਥਾਵਾਂ ਚਲਾਈਆਂ ਹੋਈਆਂ ਹਨ ਜਿਵੇਂ ਕਿ ਉਹਨਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ ਜਿਹਦੇ ਨਾਲ ਉਹਨਾਂ ਦੇ ਖਰਚਿਆਂ ਵਿੱਚ ਉਹਨਾਂ ਨੂੰ ਖਰਚੇ ਆਪਾਂ ਜਿਹਨਾਂ ਜਿਹਦੇ ਵਿੱਚ ਕਿ ਉਹਨਾਂ ਨੂੰ ਆਪਣੇ ਖਰਚੇ ਕਰਨ ਵਿੱਚ ਬਹੁਤ ਹੀ ਆਸਾਨੀ ਹੋ ਜਾਂਦੀ ਹੈ ਅਤੇ ਲੀਡਰ ਯੂਨੀਅਨ ਵਾਸਤੇ ਵੀ ਉਹਨਾਂ ਨੇ ਬਹੁਤ ਕੁਛ ਵਧੀਆ ਤਰੀਕੇ ਵਧੀਆ ਚਲਾਇਆ ਹੈ ਜਿੱਦਾਂ ਕਿ ਕਿਸੇ ਨੂੰ ਕੋਈ ਲੇਬਰ ਵਰਕਰ ਹੈ ਉਹਨੂੰ ਕੰਮ ਕਰਨ ਵਿੱਚ ਤਕਲੀਫ ਹੁੰਦੀ ਹੈ ਤਾਂ ਉਹ ਤਕਲੀਫ ਹੈ ਜਾਂ ਕੋਈ ਉਹਦੀ ਸੁਣਵਾਈ ਨਹੀਂ ਹੋ ਰਹੀ ਜਾਂ ਉਹਦੀ ਸੈਲਰੀ ਟਾਈਮ ਨਾਲ ਨਹੀਂ ਮਿਲ ਰਹੀ ਅਤੇ ਉਹ ਗਵਰਨਮੈਂਟ ਅਤੇ ਜਾ ਕੇ ਇਹਨਾਂ ਨੇ ਸੰਸਥਾਵਾਂ ਇੱਦਾਂ ਦੀਆਂ ਚਲਾਈਆਂ ਹਨ ਕਿ ਉਹ ਓਹ ਸੰਸਥਾ ਵਿੱਚ ਜਾ ਕੇ ਉਹਦੀ ਸ਼ਿਕਾਇਤ ਕਰ ਸਕਦਾ ਹੈ ਜਿਸ ਨਾਲ ਬਹੁਤ ਹੀ ਜਲਦੀ ਗਵਰਮੈਂਟ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਅਤੇ ਉਹਦੀ ਸੁਣਵਾਈ ਹੋ ਜਾਂਦੀ ਹੈ ਜਿਸ ਨਾਲ ਉਹਦੇ ਪਰਿਵਾਰ ਨੂੰ ਅਤੇ ਉਹਨੂੰ ਵੀ ਕੰਮ ਕਰਨ ਵਿੱਚ ਕੋਈ ਵੀ ਤੰਗੀ ਨਹੀਂ ਆਉਂਦੀ ਅਤੇ ਉਹਦਾ ਜੀਵਨ ਬਹੁਤ ਹੀ ਸਰਲਤਾ ਨਾਲ ਚਲਦਾ ਹੈ ਅਤੇ ਉਹ ਹੋਰ ਵੀ ਵਿਕਾਸ ਅਤੇ ਵਾਧਾ ਉਹਦੇ ਕੰਮ ਵਿੱਚ ਹੋ ਸਕਦਾ ਹੈ ਹੋਰ ਵੀ ਬਹੁਤ ਕੁਝ ਗਵਰਮੈਂਟ ਨੇ ਇਹਨਾਂ ਲੋਕਾਂ ਲਈ ਚਲਾਣ ਲਈ ਸੋਚਿਆ ਹੈ ਧੰਨਵਾਦ